ਹੈਲੋ ਹਾਂਜੀ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਹੋਰ ਸਟੇਸ਼ਨਰੀ ਲੈਣੀ ਸੀ ਬੱਚੇ ਦੀ ਹਾਂਜੀ ਹਾਂਜੀ ਮੈਂ ਕਿਹਾ ਸਟੇਸ਼ਨਰੀ ਲੈਣੀ ਸੀ ਬੱਚੇ ਦੀ ਹਾਂ ਹਾਂ ਅਤੇ ਬੱਚਾ ਥਰਡ ਕਲਾਸ ਦੇ ਵਿੱਚ ਹੈ ਅਤੇ ਫਿਰ ਉਹ ਉਹਨੂੰ ਕੀ ਕੀ ਮਤਲਬ ਚਾਹੀਦਾ ਹੋਊਗਾ ਜਿਵੇਂ ਪੈਨਸਲ ਹੋ ਗਈ ਰੇਜ਼ਰ ਹੋ ਗਈ ਮੈਂ ਕਿਹਾ ਜਿਵੇਂ ਜੀ ਪੈਂਸਿਲ ਹੋ ਗਈ ਰੇਜ਼ਰ ਹੋ ਗਈ ਪੈਂਨਸਿਲ ਦਾ ਰੇਟ ਹੈ ਜੀ ਇਹ ਰੇਜ਼ਰ ਦਾ ਰੇਜ਼ਰ ਇੱਕ ਪੰਜ ਰੁਪਏ ਦੀ ਪਊਗੀ ਅਤੇ ਪੈਨਸਿਲ ਇੱਕ ਕਿੰਨੇ ਦੀ ਪਊਗੀ ਜੀ ਹਾਂਜੀ ਹਾਂ ਪੈਂਨਸਿਲ ਕਿੰਨੇ ਦੀ ਪਊਗੀ ਇੱਕ ਪੰਜ ਰੁਪਏ ਦਾ ਇੱਕ ਪੀਸ

ਠੀਕ ਹੈ ਅਤੇ ਸਕੇਲ ਹਾਂ ਅੱਛਾ ਪਲਾਸਟਿਕ ਵਾਲਾ ਤੀਹ ਰੁਪਏ ਦਾ ਠੀਕ ਹੈ ਠੀਕ ਹੈ ਅਤੇ ਉਹ ਇਹ ਆਪਣਾ ਬੋਰਡ ਪੇਪਰ ਇਗਜ਼ਾਮ ਜਿਹ 'ਤੇ ਇਗਜ਼ਾਮ ਦਿੰਦੇ ਹੁੰਦੇ ਹਾਂ ਆਪਾਂ ਉਹ ਕਿੰਨੇ ਦਾ ਠੀਕ ਹੈ ਠੀਕ ਹੈ ਅਤੇ ਸ਼ੋਪਨਰ ਸ਼ੋਪਨਰ

ਅਤੇ ਕਾਪੀ ਕਾਪੀਆਂ ਕਿਹੜੀਆਂ ਦੇਉਗੇ

ਠੀਕ ਹੈ ਹੈਲੋ ਹਾਂਜੀ ਹਾਂਜੀ ਹਾਂਜੀ ਬੋਲੋ ਇੱਧਰ ਬੱਚੇ ਨੂੰ ਰਜਿਸਟਰ ਦੀ ਤਾਂ ਕੀ ਲੋੜ ਹੈ ਕਾਪੀ ਦੀ ਲੋੜ ਪਊਗੀ ਠੀਕ ਹੈ ਚਲੋ ਫਿਰ ਮੈਂ ਅਨ ਠੀਕ ਹੈ ਫੇਰਾ ਲਾਉਗੇ ਠੀਕ ਹੈ ਅਤੇ ਆਪਣਾ ਇੱਕ ਜਿਹੜੀ ਰੇਜ਼ਰ ਹੁੰਦੀ ਹੈ ਟੋਆਏ ਵਾਲੀ ਰੇਜ਼ਰ ਹੁੰਦੀ ਹੈ ਉਹ ਕਿੰਨੇ ਦੀ ਪਊਗੀ ਆਪਾਂ ਨੂੰ

ਅਤੇ ਫਿਰ ਮੈਨੂੰ ਵਿਜਿਟ ਕਰਨਾ ਪੈਣਾ ਤੁਹਾਡੇ ਕੋਲ ਹੈ ਨਾ ਦੁਕਾਨ ਦੁਕਾਨ 'ਤੇ ਆਉਣਾ ਪੈਣਾ ਚਲੋ ਆਉਂਦਾ ਫਿਰ ਮੈਂ ਹਾਂ ਠੀਕ ਹੈ ਠੀਕ ਹੈ ਜੀ ਮੈਂ ਆਉਂਦਾ